ਮੇਰਾ ਪੋਜਟਿਵ ਐਕਸਪੀਰੀਐਂਸ ਪ੍ਰੋਡਕਟ ਦਾ ਜੋ ਹੈ ਉਸਦਾ ਨਾਮ ਇੱਕ ਕੂਲਰ ਹੈ ਕੂਲਰ ਗਰਮੀਆਂ ਦੇ ਮੌਸਮ ਦੇ ਵਿੱਚ ਇੱਕ ਬਹੁਤ ਹੀ ਵਧੀਆ ਠੰਡੀ ਹਵਾ ਦੇਣ ਦਾ ਇੱਕ ਇਲੈਕਟ੍ਰੋਨਿਕ ਪ੍ਰੋਡਕਟ ਹੈ ਇਹ ਭਾਵੇਂ ਸਵੇਰੇ ਸ਼ਾਮ ਹਲਕੀ ਠੰਡ ਦਿੰਦਾ ਹੈ ਪਰ ਦਿਨ ਵਿੱਚ ਗਰਮੀ ਹੁੰਦੇ ਹੋਏ ਵੀ ਇਸ ਵਿੱਚ ਪਾਣੀ ਪਾਉਣ ਦੇ ਉੱਤੇ ਇਹ ਇੱਕ ਬਹੁਤ ਹੀ ਠੰਡੀ ਨੈਚੁਰਲ ਹਵਾ ਦਿੰਦਾ ਹੈ ਉੱਤਰ ਭਾਰਤ ਦੇ ਲੋਕਾਂ ਦੇ ਵਿੱਚ ਪੱਖੇ ਚਲਾਉਣਾ ਜਿਵੇਂ ਕਿ ਇੱਕ ਪ੍ਰੰਪਰਾ ਹੈ ਉਸ ਤਰ੍ਹਾਂ ਕੂਲਰ ਦੇ ਨਾਲ ਉਹ ਪ੍ਰੰਪਰਾ ਵੀ ਅੱਛੀ ਰਹਿੰਦੀ ਹੈ ਇਸ ਲਈ ਜਦੋਂ ਹੋਰ ਗਰਮੀ ਵਧੇਗੀ ਤਾਂ ਲੋਕ ਕੂਲਰ ਅਤੇ ਏਸੀ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਏਸੀ ਜਿੱਥੇ ਕੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਓੁੱਥੇ ਕੂਲਰ ਦੇ ਨਾਲ ਤਰੋ ਤਾਜ਼ਗੀ ਮਿਲਦੀ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਕੂਲਰ ਸਹੀ ਚੂਜ਼ ਕਰਦੇ ਹੋਂ ਤਾਂ ਉਸ ਤਰੀਕੇ ਦਾ ਤੁਹਾਨੂੰ ਰਿਜਲਟ ਮਿਲਦਾ ਹੈ ਮਾਰਕਿਟ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਸਸਤੇ ਤੋਂ ਸਸਤੇ ਅਤੇ ਮਹਿੰਗੇ ਤੋਂ ਮਹਿੰਗੇ ਕੂਲਰ ਅਵੇਲਬਲ ਹਨ ਜਿਸ ਪਰ ਤੁਸੀਂ ਇਸ ਕੂਲਰ ਨੂੰ ਚੰਗੀ ਚੋਣ ਕਰਕੇ ਹੀ ਖਰੀਦਣਾ ਹੈ ਜਿਸ ਕਰਕੇ ਕੂਲਰ ਠੀਕ ਤਰ੍ਹਾਂ ਕੰਮ ਕਰੇ ਪਰ ਚਿੰਤਾ ਨਾ ਕਰੋ ਅਸੀਂ ਤੁਹਾਨੂੰ ਕੁਝ ਅਸਾਨ ਟਿਪਸ ਦਵਾਂਗੇ ਜਿਸ ਨਾਲ ਤੁਸੀਂ ਮਿੰਟਾਂ ਦੇ ਵਿੱਚ ਕੂਲਰ ਖਰੀਦਣ ਲਈ ਇੱਕ ਵਧੀਆ ਅਡਵਾਈਜ ਮਿਲ ਸਕਦੀ ਹੈ ਧੰਨਵਾਦ